ਹਾਂਜੀ ਬਾਬਾ ਜੀ ਸਾਸੀਕਾਲ ਠੀਕ ਹੋ ਕਿਵੇਂ ਸਿਹਤਾਂ ਠੀਕ ਰਹਿੰਦੀ ਆਂਗਾ ਹਾਂਜੀ ਮੈਂ ਨਾ ਉਹ ਰਜਿਸਟਰੇਸ਼ਨ ਵਾਲੇ ਦਫਤਰ ਨਾਲ ਗੱਲ ਕਰ ਲਈ ਤੇ ਉਹ ਕਹਿੰਦੇ ਅੱਜ ਛੁੱਟੀ ਆ ਤੁਸੀਂ ਆਪਣੇ ਬੱਚੇ ਦਾ ਨਾਮ ਕੀ ਰੱਖਿਆ ਗਾ ਅੱਛਾ ਮਨ ਫਤਿਹ ਸਿੰਘ ਜੀ ਠੀਕ ਹੈ ਹਾਂ ਉਹ ਕਹਿੰਦੇ ਵੀ ਕੱਲ ਨੂੰ ਵੀ ਅਸੀਂ ਉਹ ਕਰ ਦਾਂਗੇ ਥਓਡੀ ਅਰਜੀ ਪਾਸ ਕਰ ਦਾਂਗੇ ਰਜਿਸਟਰੇਸ਼ਨ ਆਲੀ ਤੇ ਕੱਲ ਦਫਤਰ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਸੀਗੀ ਤੁਸੀਂ ਟੈਂਸ਼ਨ ਨਾ ਲਾ ਲਿਆ ਕਰੋ ਆਰਾਮ ਕਰਿਆ ਕਰੋ ਹੋਰ ਇਹ ਤਾਂ ਕੰਮ ਹੋ ਹੀ ਜਾਣਾਗਾ ਹਾਂਜੀ ਰਜਿਸਟਰੇਸ਼ਨ ਦੀ ਅਰਜੀ ਆਪਣੀ ਦਿੱਤੀ ਹੋਈ ਆ ਉਹ ਹੌਲੀ ਹੌਲੀ ਪਾਸ ਹੁੰਦੀ ਹ ਨਾ ਫਿਰ ਇਸ ਲੀਏ ਤੇ ਤਾਂ ਕਰਕੇ ਤੇ ਉਹਨਾਂ ਨੂੰ ਫੋਨ ਕੀਤਾ ਸੀਗਾ ਕੱਲ ਨੂੰ ਪਤਾ ਕਰ ਲਾਂਗੇ ਅੱਜ ਛੁੱਟੀ ਆ ਤੁਸੀਂ ਆਰਾਮ ਕਰਿਆ ਕਰੋ ਵੀ ਟੈਂਸ਼ਨ ਨਾ ਲਿਆ ਕਰੋ ਕਿਉਂਕੀ ਇਹ ਤਾਂ ਹੋਈ ਜਾਣਾ ਕੰਮ ਹਨਾ ਰਜਿਸਟਰੇਸ਼ਨ ਅਰਜੀ ਜਨਮ ਸਰਟੀਫਿਕੇਟ ਦੀ ਤੇ ਉਹਨਾਂ ਨੂੰ ਕੱਲ ਨੂੰ ਜਾ ਕੇ ਸਕੂਟੀ ਪਰ ਜਾ ਕੇ ਮੈਂ ਪਤਾ ਕਰ ਲਊਂਗਾ ਹਾਂਜੀ ਕੋਈ ਗੱਲ ਨਹੀਂ ਇਹ ਹਾਂ ਰਜਿਸਟਰੇਸ਼ਨ ਆਨਲਾਈਨ ਦਿੱਤੀ ਵੀ ਹੈ ਨਾ ਅਰਜੀ ਉਹ ਹੋ ਜਾਣੀ ਆ ਤੇ ਹਾਂਜੀ ਆਪਣੇ ਬੱਚੇ ਦਾ ਨਾਮ ਰਜਿਸਟਰੇਸ਼ਨ ਹੋ ਜਾਣਾ ਤੇ ਕੱਲ ਨੂੰ ਜਾ ਕੇ ਤੇ ਪਤਾ ਕਰ ਲਾਂਗੇ ਤੁਸੀਂ ਟੈਂਸ਼ਨ ਨਾ ਲੋ ਆਰਾਮ ਕਰਿਆ ਕਰੋ ਹਾਂਜੀ ਠੀਕ ਹੈ ਦਫਤਰ ਵਾਲਿਆਂ ਨਾਲ ਫੋਨ ਤੇ ਗੱਲ ਕਰ ਲਈ ਸੀ ਉਹ ਕਹਿੰਦੇ ਕੱਲ ਨੂੰ ਆ ਜਾਓ ਤੁਸੀਂ ਤੇ ਇਥੇ ਪਤਾ ਕਰ ਲਿਓ ਤੇ ਅੱਜ ਵੀ ਮੈਂ ਕੀਤਾ ਸੀਗਾ ਕੱਲ ਕਰਿਆ ਸੀ ਫੋਨ ਅੱਜ ਉਹਨਾਂ ਨੂੰ ਚੱਕਿਆ ਨਹੀਂ ਛੁੱਟੀ ਕਰਕੇ ਤੇ ਕੱਲ ਨੂੰ ਜਾ ਕੇ ਪਤਾ ਕਰ ਲਾਂਗੇ ਆਪਣੀ ਰਜਿਸਟਰੇਸ਼ਨ ਦੀ ਅਰਜੀ ਦਿੱਤੀ ਵੀ ਆ ਪਾਸ ਹੋਗੀ ਹੋਜੂਗੀ ਹਾਂਜੀ ਠੀਕ ਹੈ